ਸਾਡੇ ਖੇਤਰ ਵਿੱਚ ਕੁਦਰਤੀ ਸ੍ਰੋਤ ਖੂਹ ਟਿਊਬ ਨਹਿਰਾਂ ਝੀਲਾਂ ਆਦਿ ਪਾਈਆਂ ਜਾਂਦੀਆਂ ਹਨ ਅਤੇ ਇਹਨਾਂ ਵਿੱਚ ਬਾਗਾਂ ਨੂੰ ਵੀ ਆਪਾਂ ਗਿਣ ਸਕਦੇ ਹਾਂ ਬਾਗਾਂ ਦੇ ਵਿੱਚ ਫਲਾਂ ਦੀ ਖੇਤੀ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਫਲਾਂ ਦੀ ਖੇਤੀ ਦੇ ਨਾਲ ਸਾਨੂੰ ਵਪਾਰਕ ਫਾਇਦਾ ਹੁੰਦਾ ਹੈ ਜਿਨ੍ਹਾਂ ਨੂੰ ਅਸੀਂ ਵੇਚ ਕੇ ਆਰਥਿਕ ਆਪਣੀ ਹਾਲਤ ਸੁਧਾਰ ਸਕਦੇ ਹਾਂ ਅਤੇ ਫੁੱਲਾਂ ਨੂੰ ਵੀ ਬਹੁਤ ਵੱਧ ਮਾਤਰਾ ਵਿੱਚ ਲਗਾ ਕੇ ਉਨ੍ਹਾਂ ਦਾ ਵਪਾਰਕ ਪੱਧਰ 'ਤੇ ਉਨ੍ਹਾਂ ਨੂੰ ਲੈ ਜਾ ਸਕਦੇ ਹਾਂ ਅਤੇ ਖੂਹ ਖੂਹਾਂ ਦਾ ਪਾਣੀ ਅਸੀਂ ਪੀਣ ਲਈ ਵਰਤਦੇ ਹਾਂ ਅਤੇ ਨਹਿਰਾਂ ਟਿਊਵੈੱਲਾਂ ਦਾ ਪਾਣੀ ਅਸੀਂ ਆਪਣੀਆਂ ਫਸਲਾਂ ਨੂੰ ਪਾਣੀ ਦੇਣ ਲਈ ਵਰਤਦੇ ਹਾਂ